ਹਰ ਇੱਕ ਖੇਤਰ ਦੀ ਆਪਣੀ ਅਲੱਗ ਅਲੱਗ ਤਰ੍ਹਾਂ ਦੇ ਰਵਾਇਤੀ ਕੱਪੜੇ ਹੁੰਦੇ ਹਨ ਹਰ ਏਰੀਏ ਦੇ ਹਰ ਸ਼ਹਿਰ ਦੇ ਆਪਣੇ ਤਰ੍ਹਾਂ ਦੇ ਰਵਾਇਤੀ ਕੱਪੜੇ ਹੁੰਦੇ ਹਨ ਇਸੇ ਤਰ੍ਹਾਂ ਹੀ ਸਾਡੇ ਆਪਣੇ ਸ਼ਹਿਰ ਦੇ ਵਿੱਚ ਵੀ ਪੰਜਾਬੀ ਸਟਾਈਲ ਦੇ ਸੂਟ ਚੱਲਦੇ ਹਨ ਪ ਪੂਰੀ ਤਰ੍ਹਾਂ ਪੰਜਾਬੀ ਸੂਟ ਜੋ ਕਿ ਪੁਰਾਣੇ ਜ਼ਮਾਨੇ ਤੋਂ ਹੀ ਚੱਲਦੇ ਆ ਰਹੇ ਹਨ ਸਲਵਾਰ ਸੂਟ ਪਟਿਆਲਾ ਸੂਟ ਚੱਲਦੇ ਹਨ ਜ਼ਿਆਦਾਤਰ ਇੱਥੇ ਫੁਲਕਾਰੀ ਦੇ ਦੁਪੱਟੇ ਤਿਆਰ ਕੀਤੇ ਜਾਂਦੇ ਹਨ ਅੱਗੇ ਤਾਂ ਇਹ ਫੁਲਕਾਰੀਆਂ ਸਿਰਫ ਹੱਥ ਦੇ ਨਾਲ ਹੀ ਕਢਾਈ ਕੀਤੀਆਂ ਜਾਂਦੀਆਂ ਸੀ ਅੱਜ ਕੱਲ੍ਹ ਮਸ਼ੀਨੀ ਯੁੱਗ ਦੇ ਵਿੱਚ ਆ ਕੇ ਹੁਣ ਇਹ ਕੰਪਿਊਟਰ ਦੇ ਨਾਲ ਵੀ ਕਢਾਈਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਜਿਹੜੇ ਕਿ ਇਹ ਹੈ ਕਿ ਜਿਹੜੇ ਹੱਥ ਦੀਆਂ ਕਢਾਈਆਂ ਵਾਲੀਆਂ ਫੁਲਕਾਰੀਆਂ ਹੁੰਦੀਆਂ ਹਨ ਉਹ ਥੋੜ੍ਹੀਆਂ ਮਹਿੰਗੀਆਂ ਮਿਲਦੀਆਂ ਨੇ ਜਿਹੜੀਆਂ ਅੱਜ ਕੱਲ੍ਹ ਕੰਪਿਊਟਰ 'ਤੇ ਤਿਆਰ ਹੋਣੀਆਂ ਸ਼ੁਰੂ ਹੋ ਗਈਆਂ ਉਹਨਾਂ ਦਾ ਰੇਟ ਥੋੜ੍ਹਾ ਜਿਹਾ ਘੱਟ ਹੁੰਦਾ ਜਿਹੜਾ ਕਿ ਹਰ ਕਿਸੇ ਦੇ ਲੈਣ ਯੋਗ ਹੋ ਜਾਂਦਾ ਜਿਹੜੇ ਟੂਰਿਸਟ ਆਉਂਦੇ ਨੇ ਵੱਖਰੇ ਵੱਖਰੇ ਦੇਸ਼ਾਂ ਤੋਂ ਲੋਕ ਇੱਥੇ ਆਉਂਦੇ ਨੇ ਉਹ ਇਹਨੂੰ ਫੁਲਕਾਰੀਆਂ ਨੂੰ ਇੱਕ ਤੋਹਫੇ ਦੇ ਰੂਪ 'ਚ ਇੱਥੋਂ ਲੈ ਕੇ ਜਾਂਦੇ ਉਹ ਜਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਇੱਥੋਂ ਦੀ ਦਿੰਦੇ ਨੇ ਫੁਲਕਾਰੀ ਜਦੋਂ ਤੋਹਫੇ ਦੇ ਰੂਪ ਦੇ ਵਿੱਚ ਉਹ ਵੀ ਇਸ ਚੀਜ਼ ਨੂੰ ਲੈ ਕੇ ਖੁਸ਼ ਹੁੰਦੇ ਨੇ ਜਿਹੜੀਆਂ ਹੱਥ ਦੀਆਂ ਬਣੀਆਂ ਫੁਲਕਾਰੀਆਂ ਇੱਕ ਤਾਂ ਹੁਣ ਉਹ ਘੱਟ ਮਿਲਦੀਆਂ ਨੇ ਜੇ ਮਿਲਦੀਆਂ ਵੀ ਨੇ ਤਾਂ ਬਹੁਤ ਜ਼ਿਆਦਾ ਮਹਿੰਗੀਆਂ ਮਿਲਦੀਆਂ ਨੇ ਉਹ ਹਰ ਕਿਸੇ ਦੇ ਲੈਣ ਦੇ ਯੋਗ ਨਹੀਂ ਹੁੰਦੀ ਹਰ ਇੱਕ ਕਿਸੇ ਦੇ ਲੈਣ ਦੇ ਵੱਸ ਦੀ ਗੱਲ ਨਹੀਂ ਹੁੰਦੀ ਉਸ ਤੋਂ ਇਲਾਵਾ ਸਾਡੇ ਖੇਤਰ ਦੇ ਵਿੱਚ ਪੰਜਾਬੀ ਸੂਟ ਪਟਿਆਲਾ ਸੂਟ ਫੁੱਲ ਪਟਿਆਲਾ ਸੂਟ ਪਲਾਜੋ ਸੂਟ ਇਹਨਾਂ ਦਾ ਜ਼ਿਆਦਾ ਰਿਵਾਜ਼ ਹੈ ਫਰੋਕ ਸੂਟਾਂ ਦਾ ਬਹੁਤ ਜ਼ਿਆਦਾ ਰਿਵਾਜ਼ ਹੈ ਵਿਆਹਵਾਂ ਸ਼ਾਦੀਆਂ 'ਤੇ ਲਹਿੰਗੇ ਚੋਲੀਆਂ ਦਾ ਲਹਿੰਗੇ ਚੋਲੀ ਬਹੁਤ ਖੁੱਲ੍ਹੇ ਘੇਰੇ ਵਾਲੇ ਲਹਿੰਗੇ ਜਿਹੜੇ ਕਿ ਗਿੱਧੇ ਦੇ ਟਾਈਮ 'ਤੇ ਜ਼ਿਆਦਾ ਲੋਕ ਪਾਉਣਾ ਪਸੰਦ ਕਰਦੇ ਸੀ ਉਹ ਜ਼ਿਆਦਾ ਪਸੰਦ ਕਰਦੇ ਨੇ ਲੋਕ ਇੱਥੇ ਲੈਣਾ ਅਤੇ ਉਹਨਾਂ ਦਾ ਕਾਫੀ ਇੱਥੇ ਪ੍ਰਚਲਿਤ ਹੋਇਆ ਹੋਇਆ ਹੈ ਜਦੋਂ ਘਰ ਦੇ ਵਿੱਚ ਜਿਹਨੂੰ ਕਹਿੰਦੇ ਆ ਗੌਣ ਬਿਠਾਉਂਦੇ ਹੈ ਲੇਡੀ ਸੰਗੀਤ ਕਰਦੇ ਆ ਉਦੋਂ ਸਾਰੀਆਂ ਕੁੜੀਆਂ ਖੁੱਲ੍ਹੇ ਘੇਰੇ ਵਾਲੇ ਲਹਿੰਗੇ ਪਾ ਕੇ ਅਤੇ ਨੱਚਣਾ ਗਾਣਾ ਜ਼ਿਆਦਾ ਪਸੰਦ ਕਰਦੀਆਂ ਉਹਨਾਂ ਨੂੰ ਲੱਗਦਾ ਏ ਕਿ ਇਹ ਇੱਕ ਤਰ੍ਹਾਂ ਦਾ ਇੱਕ ਵਿਲੱਖਣ ਸਾਡੀ ਸ਼ਖਸੀਅਤ ਨੂੰ ਉਭਾਰਦਾ ਏ ਇਹ ਲਹਿੰਗਾ ਚੋਲੀ ਪਾਉਣਾ ਅਤੇ